ਮੇਰੇ ਵਿੱਚ ਸ਼ਕਤੀਆਂ ਦੇ ਨਾਲ਼ ਨਾਲ਼ ਬਹੁਤ ਕਮੀਆਂ ਵੀ ਹਨ ਜਿਵੇਂ ਕਿ ਮੈਨੂੰ ਸ਼ਕਤੀਆਂ ਜਿਵੇਂ ਕਿ ਮੇਰੇ ਵਿੱਚ ਸ਼ਕਤੀਆਂ ਹਨ ਮੈਨੂੰ ਕੂਕਿੰਗ ਦਾ ਅਤੇ ਡਰਾਇੰਗ ਦਾ ਬਹੁਤ ਸ਼ੌਕ ਹੈ ਮੈਨੂੰ ਮੈਂ ਹਰ ਤਰ੍ਹਾਂ ਦੇ ਪਕਵਾਨ ਬਣਾ ਲੈਂਦੀ ਹਨ ਅਤੇ ਰੇ ਹਰ ਇੱਕ ਤਰ੍ਹਾਂ ਦੀ ਚਿੱਤਰਕਾਰੀ ਕਰ ਲੈਂਦੀ ਹਾਂ ਹਾਂ ਅਤੇ ਮੈਨੂੰ ਇਹ ਸਭ ਕਰਨਾ ਬਹੁਤ ਵਧੀਆ ਲੱਗਦਾ ਹੈ ਅਤੇ ਨਵੇਂ ਨਵੇਂ ਫ੍ਰੈਡਜ਼ ਵੀ ਬਣਾਉਣਾ ਵਧੀਆ ਲੱਗਦਾ ਹੈ ਕਮਜ਼ੋਰੀਆਂ ਮੈਨੂੰ ਕਮਜ਼ੋਰੀਆਂ ਮੇਰੇ ਕਮਜ਼ੋਰੀਆਂ ਵਿੱਚ ਮੈਨੂੰ ਡਸਟਿੰਗ ਵਗੈਰਾ ਨਹੀਂ ਪਸੰਦ ਮੈਨੂੰ ਗੰਦਾ ਕੂੜਾ ਕਰਕਟ ਨਹੀਂ ਪਸੰਦ ਅਤੇ ਮੈਨੂੰ ਸਫਾਈ ਪਸੰਦ ਹੈ ਅਤੇ ਮੈਨੂੰ ਘੁੰਮਣਾ ਫਿਰਨਾ ਅਵਾਰਾ ਗਰਦੀਆਂ ਕਰਨਾ ਨਹੀਂ ਪਸੰਦ